ਹਾਂਜੀ ਸਕੂਲ ਵਿੱਚ ਜਿਹੜੀ ਮੈਂ ਪੇਂਟਿੰਗ ਸਿੱਖੀ ਸੀ ਉਹਦੇ ਬਾਰੇ ਤਾਂ ਮੈਨੂੰ ਕਾਫੀ ਇੰਟਰਸਟ ਹੈਗਾ ਸੀ ਅਤੇ ਉਹ ਕਾਫੀ ਮੇਨ ਉਹਦਾ ਹੁੰਦਾ ਵਾ ਕਿ ਕਲਰ ਕੰਬੀਨੇਸ਼ਨ ਅਸੀਂ ਠੀਕ ਕਰੀਏ ਪਰ ਇਹ ਹੈ ਕਿ ਅਸੀਂ ਪੇਂਟਿੰਗ ਕਰਦੇ ਕੁਛ ਆ ਅਤੇ ਬਣਾ ਬਣ ਕੁਛ ਜਾਂਦੀ ਹੈ ਉਹਦਾ ਇਹ ਥੋੜ੍ਹਾ ਮੁਸ਼ਕਿਲ ਹੈਗੀ ਹੈ ਪਰ ਇਹ ਵਾ ਗੱਲ ਕਿ ਪ੍ਰੈਕਟਿਸ ਕਰਨ ਨਾਲ ਕੁਛ ਵੀ ਹੋ ਸਕਦਾ ਅਤੇ ਪ੍ਰੈਕਟਿਸ ਕਰਨ ਨਾਲ ਕਾਫੀ ਹੌਲੀ ਹੌਲੀ ਫਿਰ ਮੇਰੀ ਡਿਵੈਲਪ ਹੁੰਦੀ ਗਈ ਪੇਂਟਿੰਗ ਅਤੇ ਫਿਰ ਉਸ ਤੋਂ ਬਾਅਦ ਮੈਂ ਪੇਂਟਿੰਗ ਜਿਹੜੀ ਸਕੂਲ ਦੇ ਲੈਵਲ ਦੀ ਸਿੱਖੀ ਹੋਈ ਸੀ ਉਸ ਤੋਂ ਬਾਅਦ ਮੈਂ ਉਹ ਕੋਲੇਜ ਲੈਵਲ 'ਤੇ ਵੀ ਕਰਕੇ ਦਿਖਾਈ ਅਤੇ ਕਾਫੀਆਂ ਨੂੰ ਲੋਕਾਂ ਨੂੰ ਪਸੰਦ ਆਉਂਦੀ ਸੀ ਮੇਰੇ ਪ੍ਰਿੰਸੀਪਲ ਮੈਮ ਨੂੰ ਵੀ ਪਸੰਦ ਆਈ ਅਤੇ ਉਹਨਾਂ ਨੇ ਮੈਨੂੰ ਕਾਫੀ ਸਲਾਹਿਆ ਪਰ ਇਹ ਹੈ ਕਿ ਅਸੀਂ ਇਸ ਦਿਸ਼ਾ ਵਿੱਚ ਕੰਮ ਕਰਦੇ ਰਹੀਏ ਅਤੇ ਫਿਰ ਇਹਦੇ ਵਿੱਚ ਡਿਵੈਲਮੈਂਟ ਹੋ ਸਕਦੀ ਹੈ ਅਤੇ ਨਾਲ ਕਿਸੇ ਨੂੰ ਦੇਖਦੇ ਵੀ ਰਹੀਏ ਕਿ ਕੋਈ ਕਿਸ ਤਰ੍ਹਾਂ ਕਰਦਾ ਪਿਆ ਅਤੇ ਉਹਨੂੰ ਵੀ ਫੋਲੋ ਕਰੀਏ ਜਿਹਨਾਂ ਦੀ ਪੇਂਟਿੰਗ ਬਹੁਤ ਅੱਛੀ ਹੈ ਅਤੇ ਉਹਨਾਂ ਨੂੰ ਵੀ ਮੈਂ ਫੋਲੋ ਕਰਦੀ ਸੀ ਅਤੇ ਇਸੇ ਕਰਕੇ ਫਿਰ ਮੇਰੀ ਹੌਲੀ ਹੌਲੀ ਪੇਂਟਿੰਗ ਡਿਵੈਲਪ ਹੁੰਦੀ ਗਈ ਅਤੇ ਮੈਂ ਐਸਾ ਹੀ ਦੇਖ ਦੇਖ ਕੇ ਸਿੱਖਦੀ ਗਈ